ਹਾਂ ਮੈਂ ਆਪਣੇ ਇਲਾਕੇ ਤੋਂ ਬਾਹਰੀ ਯਾਤਰਾ ਕਰਦੇ ਸਮੇਂ ਵਿਤਕਰੇ ਜਾਂ ਪੱਖਪਾਤ ਦਾ ਅਨੁਭਵ ਕੀਤਾ ਹੈ ਜਿਵੇਂ ਕਿ ਅਮੀਰ ਲੋਕ ਅਤੇ ਗਰੀਬ ਲੋਕ ਇਹਨਾਂ ਵਿੱਚ ਬਹੁਤ ਹੀ ਫ਼ਰਕ ਸਮਝਿਆ ਜਾਂਦਾ ਹੈ ਅਸੀਂ ਬਸ 'ਚ ਜਿੱਦਾਂ ਕਿਤੇ ਵੀ ਸਫ਼ਰ ਕਰਦੇ ਹਾਂ ਤਾਂ ਅਮੀਰ ਲੋਕ ਆ ਜਿਹੜੇ ਉਹ ਪੈਸੇ ਦੇ ਕੇ ਉਹਨਾਂ ਦੀ ਵੀ ਸੀਟ ਖਰੀਦ ਲੈਂਦੇ ਹਨ ਤਾਂ ਜਿਹੜੇ ਗਰੀਬ ਲੋਕ ਹੈ ਉਹ ਵਿਚਾਰੇ ਫਿਰ ਖੜੇ ਰਹਿ ਜਾਂਦੇ ਹਨ ਜਿਵੇਂ ਕਿਸੇ ਵੀ ਭੀੜ 'ਚ ਜਾਂ ਗ਼ਰੀਬਾਂ ਨੂੰ ਕੋਈ ਵੀ ਮਤਲਬ ਲੋੜ ਹੋਵੇ ਜਾਂ ਕਿਤੇ ਜਲਦੀ ਜਾਣਾ ਹੋਵੇ ਤਾਂ ਉਹਨਾਂ ਨੂੰ ਨਹੀਂ ਜਾਣ ਦਿੰਦੇ ਔਰ ਉਹਨਾਂ ਦੀ ਜਗ੍ਹਾ ਅਗਰ ਅਮੀਰ ਲੋਕ ਹੋਣ ਤਾਂ ਉਹਨਾਂ ਲਈ ਰਾਹ ਬਹੁਤ ਜਲਦੀ ਖੁੱਲ੍ਹ ਜਾਂਦੇ ਨੇ ਇਹਨਾਂ ਵਿੱਚ ਬਹੁਤ ਹੀ ਪੱਖਪਾਤ ਕੀਤਾ ਜਾਂਦਾ ਹੈ ਵਿਤਕਰਾ ਕੀਤਾ ਜਾਂਦਾ ਹੈ ਜਿੱਦਾਂ ਕਿਤੇ ਵੀ ਮੰਨ ਲਓ ਕੋਈ ਵੀ ਜਗ੍ਹਾ ਜਾਏ ਠੀਕ ਆ ਤਾਂ ਉੱਥੇ ਅਮੀਰ ਲੋਕ ਔਰ ਗਰੀਬ ਲੋਕਾਂ 'ਚ ਬਹੁਤ ਹੀ ਅੰਤਰ ਸਮਝਿਆ ਜਾਂਦਾ ਹੈ ਬਹੁਤ ਹੀ ਜ਼ਿਆਦਾ ਫ਼ਰਕ ਸਮਝਦੇ ਨੇ ਅਮੀਰ ਲੋਕ ਆ ਜਿਹੜੇ ਉਹ ਗਰੀਬਾਂ ਨੂੰ ਕੁਛ ਨਹੀਂ ਸਮਝਦੇ ਉਹਨਾਂ ਦੇ ਮਤਲਬ ਉਹਨਾਂ ਲਈ ਤਾਂ ਉਹ ਕੁਛ ਵੀ ਨਹੀਂ ਆ ਉਹਨਾਂ ਦੇ ਮੂੰਹ ਤੋਂ ਰੋਟੀ ਖੋਹ ਕੇ ਖਾ ਲੈਂਦੇ ਨੇ ਐਦਾਂ ਦਾ ਅੱਜ ਕੱਲ੍ਹ ਐਦਾਂ ਦੇ ਹਾਲਾਤ ਆ ਗਏ ਨੇ ਕਿ ਜਿੱਦਾਂ ਅਮੀਰ ਗਰੀਬ 'ਚ ਇੰਨਾ ਅੰਤਰ ਸਮਝਿਆ ਜਾਂਦਾ ਹੈ ਬਹੁਤ ਹੀ ਜ਼ਿਆਦਾ ਧੰਨਵਾਦ